ਹੈਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮੈਂ ਨਾ ਟੂਰਿਸਟ ਦੇ ਤੌਰ 'ਤੇ ਇੱਥੇ ਮਤਲਬ ਆਈ ਹਾਂ ਮੈਂ ਆਈ ਹਾਂ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਜੀ ਅਤੇ ਮੈਂ ਅ ਇੱਥੇ ਦਰਸ਼ਨ ਕਰਨ ਲਈ ਆਈ ਸੀ ਦਰਬਾਰ ਸਾਹਿਬ ਵਿਖੇ ਅਤੇ ਹਾਂਜੀ ਅਤੇ ਮੈਨੂੰ ਥੋੜ੍ਹਾ ਜਿਹਾ ਮੈਂ ਇੱਥੋਂ ਦੀ ਜਿਹੜੀ ਹੈ ਮਤਲਬ ਇਤਿਹਾਸ ਦੇ ਬਾਰੇ ਮੈਨੂੰ ਥੋੜ੍ਹਾ ਬਹੁਤਾ ਮਤਲਬ ਤੁਸੀਂ ਜਾਣਕਾਰੀ ਦੇ ਸਕਦੇ ਹੋ ਕੁਛ ਮਤਲਬ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਹਾਂਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇੰਨੀ ਵਧੀ ਵਧੀਆ ਜਾਣਕਾਰੀ ਦਿੱਤੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ